ਪੰਜਾਬ ਵਿੱਚ ਪੰਜਾਬ ਦੀ ਮਾਤਰ ਭਾਸ਼ਾ ਪੰਜਾਬੀ ਹੈ ਜਿਹਨੂੰ ਕਿ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਇਹ ਬਹੁਤ ਮਿੱਠੀ ਭਾਸ਼ਾ ਹੈ ਅਤੇ ਇਹ ਹਿੰਦੀ ਅਤੇ ਉਰਦੂ ਦੇ ਸੁਮੇਲ ਨਾਲ ਬਣੀ ਹੈ ਇਹਦੇ ਵਿੱਚ ਕਈ ਸ਼ਬਦ ਹਿੰਦੀ ਦੇ ਵੀ ਹਨ ਅਤੇ ਕਈ ਸ਼ਬਦ ਉਰਦੂ ਦੇ ਵੀ ਹਨ ਜਦੋਂ ਕਿਤੇ ਬਾਹਰ ਕੋਈ ਪੰਜਾ ਇੱਕ ਪੰਜਾਬੀ ਦੂਸਰੇ ਪੰਜਾਬੀ ਨੂੰ ਮਿਲਦਾ ਹੈ ਤਾਂ ਉਹ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ ਜਿਹਦੇ ਕਰਕੇ ਕਿ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਆਪਣੇ ਦੇਸ਼ ਦੀ ਯਾਦ ਆਉਂਦੀ ਹੈ ਪੰਜਾ ਪੰਜਾਬ ਦੇ ਵਿੱਚ ਪੰਜਾਬੀ ਹਰ ਦਸ ਕਿਲੋਮੀਟਰ ਤੋਂ ਬਾਅਦ ਇੱਕ ਅਲੱਗ ਤਰੀਕੇ ਨਾਲ ਬੋਲੀ ਜਾਂਦੀ ਹੈ ਇਹ ਸਾਨੂੰ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖਦੀ ਹੈ ਹੁਣ ਜਿਵੇਂ ਕਿ ਕਈ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਹੁਣ ਹਿੰਦੀ ਬੋਲੀ ਜਾਂਦੀ ਹੈ ਅਤੇ ਉੱਥੇ ਪੰਜਾਬੀ ਵੀ ਬਹੁਤ ਘੱਟ ਵਰਤੋਂ ਕਰਦੇ ਹਨ ਕਈ ਸਕੂਲ ਵੀ ਕਹਿੰਦੇ ਹਨ ਕਿ ਤੁਸੀਂ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਹੀ ਗੱਲ ਕਰੋ ਪੰਜਾਬੀ ਦੇ ਵਿੱਚ ਗੱਲ ਕਰਨ 'ਚ ਗੱਲ ਕਰਨ ਨੂੰ ਮਨਾ ਮਨਾਂ ਕਰਦੇ ਹਨ ਅਤੇ ਇਹ ਸਾਨੂੰ ਮਨਾ ਨਹੀਂ ਇਹ ਸਾਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਿਹਦੇ ਕਰਕੇ ਕਿ ਅਸੀਂ ਆਪਣਾ ਕਲਚਰ ਨਾ ਭੁੱਲੀਏ ਜੇ ਅਸੀਂ ਆਪਣਾ ਕਲਚਰ ਭੁੱਲ ਗਏ ਤਾਂ ਫਿਰ ਅੱਗੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਹੀ ਦੱਸਾਂਗੇ ਕਿ ਕਿ ਪੰਜਾਬੀ ਵੀ ਇੱਕ ਬੋਲੀ ਸੀਗੀ ਅਤੇ ਉਹ ਇੱਕ ਬਹੁਤ ਮਿੱਠੀ ਬੋਲੀ ਸੀਗੀ